ਟੈਕਨੋਲਜੀ ਨੇ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਨੂੰ ਬਹੁਤ ਹੱਦ ਤੱਕ ਰੋਕ ਦਿੱਤਾ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਜੋ ਟੈਕਨੋਲਜੀ ਘੱਟ ਸੀ ਤੇ ਪਰਿਵਾਰ ਦੇ ਲੋਕ ਆਪਸ ਵਿੱਚ ਮਿਲ ਬੈਠ ਕੇ ਬਹੁਤ ਸਾਰੇ ਇਹੋ ਜਿਹੇ ਵਿਚਾਰ ਸਾਂਝੇ ਕਰਦੇ ਸੀਗੇ ਬਜ਼ੁਰਗਾਂ ਨੂੰ ਵੀ ਕਦੀ ਅਕੇਲਾਪਨ ਨਹੀਂ ਮਹਿਸੂਸ ਹੁੰਦਾ ਸੀਗਾ ਅਤੇ ਹੁਣ ਜਿਵੇਂ ਜਿਵੇਂ ਟੈਕਨੋਲਜੀ ਐਡਵਾਂਸ ਹੋ ਗਈ ਹੈ ਉਵੇਂ ਉਵੇਂ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਕਾਫੀ ਹੱਦ ਤੱਕ ਰੁੱਕ ਚੁੱਕੀ ਹੈ ਅੱਜ ਟੈਕਨੋਲਜੀ ਇੱਕ ਇਸ ਹੱਦ ਤੱਕ ਕਹਿ ਲਓ ਵੀ ਆਪਾਂ ਉਹਦਾ ਮਿਸਯੂਜ਼ ਕਰ ਰਹੇ ਇਹ ਨਹੀਂ ਆਪਾਂ ਕਹਿੰਦੇ ਵੀ ਟੈਕਨੋਲਜੀ ਦੀ ਵੀ ਕੋਈ ਸਿਰਫ ਨੁਕਸਾਨ ਹੀ ਹਨ ਬਹੁਤ ਸਾਰੇ ਇਹੋ ਜਿਹੇ ਫਾਇਦੇ ਵੀ ਹਨ ਪਰ ਸਭ ਤੋਂ ਜ਼ਿਆਦਾ ਮਾੜਾ ਅਸਰ ਜਿਹੜਾ ਪਿਆ ਹੈ ਉਹ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ 'ਤੇ ਪਿਆ ਹੈ ਕਿਉਂਕਿ ਅੱਜ ਤੁਹਾਨੂੰ ਪਤਾ ਜੇ ਆਪਾਂ ਮੋਬਾਈਲ ਫੋਨ ਦੀ ਗੱਲ ਕਰ ਲਈਏ ਤਾਂ ਮੋਬਾਈਲ ਫੋਨ ਅੱਜ ਹਰ ਘਰ ਦੇ ਹਰ ਪਰਿਵਾਰ ਦੇ ਹਰ ਜੀਅ ਕੋਲ ਆਪਣਾ ਵੱਖਰਾ ਹੁੰਦਾ ਹੈ ਮਤਲਬ ਸਾਰੇ ਲੋਕ ਮੋਬਾਈਲ ਫੋਨ 'ਚ ਇੰਨੇ ਕੁ ਜ਼ਿਆਦਾ ਰੁੱਝੇ ਹੁੰਦੇ ਆ ਵੀ ਕਿਸੇ ਕੋਲ ਕੋਈ ਸਮਾਂ ਹੀ ਨਹੀਂ ਹੁੰਦਾ ਵੀ ਕਿਸੇ ਨਾਲ ਉਹ ਗੱਲ ਕਰ ਸਕਣ ਕਿਸੇ ਨਾਲ ਆਪਦੇ ਵਿਊਜ਼ ਸ਼ੇਅਰ ਕਰ ਸਕਣ ਜਾਂ ਮਾਂ ਪਿਓ ਦਾ ਦੁੱਖ ਸੁੱਖ ਜਾਂ ਉਹਨੂੰ ਉਹਨਾਂ ਦੀ ਉਹਨਾਂ ਨਾਲ ਗੱਲ ਕਰਨ ਦਾ ਸਮਾਂ ਹੀ ਹੈ ਨਹੀਂ ਗਾ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਮਾੜਾ ਅਸਰ ਪਿਆ ਹੈ ਉਹ ਪਰਿਵਾਰਿਕ ਜੀਵਨ 'ਚ ਹੀ ਪਿਆ ਹੈ ਅਤੇ ਕਹਿ ਲਓ ਵੀ ਟੈਕਨੋਲਜੀ ਦੇ ਆਉਣ ਨਾਲ ਜੀਵਨ ਸ਼ੈਲੀ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ ਕਿੱਥੇ ਲੋਕ ਕਹਿ ਲਓ ਵੀ ਜਦੋਂ ਖਾਣਾ ਖਾਣ ਬੈਠਦੇ ਸੀਗੇ ਉਦੋਂ ਇਕੱਠੇ ਬੈਠਦੇ ਸੀ ਪਰ ਅੱਜ ਜੇ ਇਕੱਠੇ ਬੈਠਦੇ ਹੋਏ ਵੀ ਪਰਿਵਾਰ ਦਾ ਹਰ ਜੀਅ ਜਿਹੜਾ ਹੈਗਾ ਉਹ ਵੱਖ ਵੱਖ ਆਪਦੀ ਜ਼ਿੰਦਗੀ ਜਿਉਂ ਰਿਹਾ ਕਿਸੇ ਕੋਲ ਇੰਨਾਂ ਸਮਾਂ ਹੀ ਨਹੀਂ ਹੈ ਵੀ ਉਹ ਇੱਕ ਦੂਜੇ ਨੂੰ ਦੁੱਖ ਸੁੱਖ ਨੂੰ ਪੁੱਛ ਸਕਣ ਜਾਂ ਉਹਦਾ ਸਮਾਂ ਅੱਜ ਕਿਵੇਂ ਬੀਤਿਆਂ ਜਾਂ ਵੱਡਿਆਂ ਵੱਡੇ ਵਿਚਾਰੇ ਤਰਸ ਜਾਂਦੇ ਹਨ ਵੀ ਬੱਚਿਆਂ ਕੋਲ ਵੀ ਕੋਈ ਉਹ ਜਿਹਾ ਸਮਾਂ ਮਿਲ ਸਕੇ ਜਿਹਦੇ ਨਾਲ ਉਹ ਗੱਲ ਕਰ ਸਕਣ ਅਤੇ ਅੱਜ ਟੈਕਨੋਲਜੀ ਦਾ ਜਿੱਥੋਂ ਤੱਕ ਆਪਾਂ ਜਿਸ ਹੱਦ ਤੱਕ ਆਪਾਂ ਗੱਲ ਕਰ ਸਕਦੇ ਹੈ ਬੀ ਟੈਕਨੋਲਜੀ ਦਾ ਸਭ ਤੋਂ ਮਾੜਾ ਅਸਰ ਪਰਿਵਾਰਿਕ ਜੀਵਨ 'ਤੇ ਪਿਆ ਹੁਣ ਕਹਿ ਲਓ ਕਈ ਪੇਰੈਂਟਸ ਤਾਂ ਇਹੋ ਜਿਹੇ ਹੈਗੇ ਹੈ ਵੀ ਜਿਹੜੇ ਬਹੁਤ ਜ਼ਿਆਦਾ ਇਸ ਗੱਲ ਤੋਂ ਪ੍ਰਭਾਵਿਤ ਹੋਏ ਹਨ ਮਾਂ ਪਿਓ ਡਿਪਰੈਸ਼ਨ ਚ ਜਾ ਰਹੇ ਹਨ ਕਿਉਂ ਕਿਉਂਕਿ ਉਹਨਾਂ ਦੇ ਬੱਚੇ ਕੋਲ ਸਮਾਂ ਹੀ ਹੈ ਨਹੀਂ ਇੰਨੇ ਯੁੱਗ ਜਿਹੜਾ ਐਡਵਾਂਸ ਹੋ ਚੁੱਕਿਆ ਹੈ ਬੀ ਉਹਨਾਂ ਕੋਲ ਬੱਚੇ ਇੰਨੇ ਕੁ ਜ਼ਿਆਦਾ ਬਿਜ਼ੀ ਜਾਂ ਖੁੱਬ ਚੁੱਕੇ ਹਨ ਆਪਣੀ ਇਹਨਾਂ ਮੋਬਾਈਲ ਫੋਨਸ 'ਚ ਲੈਪਟੋਪ 'ਚ ਜਿਹਦੇ ਕਰਕੇ ਉਹ ਆਪਣੇ ਮਾਂ ਪਿਓ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਅਤੇ ਜਦੋਂ ਸਮਾਂ ਹੱਥ 'ਚੋਂ ਲੰਘ ਜਾਂਦਾ ਹੈ ਉਦੋਂ ਉਹ ਪਛਤਾਉਂਦੇ ਹਨ ਵੀ ਸ਼ਾਇਦ ਆਪਾਂ ਆਪਣੇ ਮਾਂ ਪਿਓ ਨੂੰ ਸਮਾਂ ਦੇ ਪਾਉਂਦੇ ਪਰ ਟੈਕਨੋਲਜੀ ਦੇ ਜਿੱਥੇ ਬਹੁਤ ਸਾਰੇ ਫਾਇਦੇ ਹਨ ਉੱਥੇ ਕਾਫੀ ਹੱਦ ਤੱਕ ਇਹਦਾ ਜਿਹੜਾ ਮਾੜਾ ਅਸਰ ਪਿਆ ਹੈ ਉਹ ਪਰਿਵਾਰਿਕ ਜੀਵਨ 'ਤੇ ਉਹਦੀ ਜੀਵਨਸ਼ੈਲੀ 'ਚ ਪਿਆ ਹੈ ਹੁਨ ਮਨੋਰੰਜਨ ਦੇ ਸਾਧਨ ਖ਼ਤਮ ਹੋ ਚੁੱਕੇ ਹਨ ਕਿਉਂ ਕਿਉਂਕਿ ਹਰ ਮਨੁੱਖ ਕੋਲ ਸਮਾਂ ਹੀ ਹੈ ਨਹੀਂ ਉਹਨੂੰ ਆਪਦੇ ਲਈ ਵੀ ਉਹਦੇ ਕੋਲ ਸਮਾਂ ਹੈ ਨਹੀਂ ਗਾ ਅਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਟੈਕਨੋਲਜੀ ਦਾ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਨੂੰ ਉਹਨੇ ਪੂਰੀ ਹੱਦ ਤੱਕ ਰੋਕ ਦਿੱਤਾ ਹੈ